ਹੈਲੋ ਬੋਲਦੇ ਜੀ ਮੈਂ ਤੁਹਾਨੂੰ ਆਪਣੇ ਪਿੰਡ ਦੀਆਂ ਦਿੱਕਤਾਂ ਬਾਰੇ ਦੱਸਣਾ ਚਾਹੁੰਦੀ ਸੀ ਬਈ ਸਾਡੇ ਪਿੰਡ 'ਚ ਨਾ ਬਈ ਸੜਕਾਂ ਦੀ ਬਹੁਤ ਦਿੱਕਤ ਆ ਰਹੀ ਹੈ ਬਈ ਸੜਕਾਂ ਬਣੀਆਂ ਹੀ ਨਹੀਂ ਹੋਈਆਂ ਤੁਹਾਨੂੰ ਕੱਚੇ ਕੱਚੇ ਰਸਤਿਆਂ ਪੈਂਦਾ ਅਸੀਂ ਸੜਕਾਂ ਵੀ ਬਣੀਆਂ ਹੀ ਨਹੀਂ ਹੋਈਆਂ ਜੇ ਬਣੀਆਂ ਵੀ ਹੋਈਆਂ ਕਈ ਤਾਂ ਉਹਨਾਂ 'ਚ ਬਹੁਤ ਟੁੱਟ ਭੱਜ ਹੋ ਚੁੱਕਾ ਅਤੇ ਖੱਡੇ ਬਣ ਚੁੱਕੇ ਆ ਨਹੀਂ ਜੀ ਸੜਕਾਂ ਟੁੱਟੀਆਂ ਪਈਆਂ ਬਣੀਆਂ ਤਾਂ ਸੀਗੀਆਂ ਪਰ ਉਹ ਥੋੜ੍ਹੇ ਦਿਨ ਹੀ ਚੱਲੀਆਂ ਅਤੇ ਉਤੋਂ ਬਾਅਦ ਉਹਨਾਂ ਤੇ ਖੱਡੇ ਪੈ ਗਏ ਅਤੇ ਹੁਣ ਉਹਨਾਂ 'ਚ ਪਾਣੀ ਭਰਿਆ ਰਹਿੰਦੇ ਅਤੇ ਉੱਥੇ ਲਾਈਟਾਂ ਵੀ ਨਹੀਂ ਲੱਗੀਆਂ ਹੋਈਆਂ ਸਾਈਡਾਂ ਅਤੇ ਸੜਕਾਂ 'ਤੇ ਸਾਈਡਾਂ 'ਤੇ ਲਾਈਟਾਂ ਵੀ ਨਹੀਂ ਹੈਗੀਆਂ ਨਹੀਂ ਖ਼ਰਾਬ ਹੋ ਗਈਆਂ ਨਾ ਬ ਕਾਫੀ ਹਾਂਜੀ ਬਈ ਲਾਈਟਾਂ ਬਹੁਤ ਮਤਲਬ ਟਾਈਮ ਹੋ ਗਿਆ ਲੱਗੇ ਨੂੰ ਤਾਂ ਕਰਕੇ ਖ਼ਰਾਬ ਹੋ ਗਈ ਹੈ ਧੁੰਦਾਂ ਕਰਕੇ ਅਤੇ ਜਿਹੜੇ ਖੱਡਿਆਂ ਹੈਗੇ ਆ ਅਤੇ ਲਾਈਟਾਂ ਵੀ ਨਹੀਂ ਹੈਗੀਆਂ ਉਹਨਾਂ ਕਰਕੇ ਕਾਫੀ ਐਕਸੀ ਐਕਸੀਡੈਂਟ ਹੋ ਜਾਂਦੇ ਆ ਕਾਫੀ ਜਣਿਆਂ ਨੂੰ ਸੱਟ ਫਿੱਟ ਲੱਗੀ ਹੋਈ ਹੈ ਹੁਣ ਤੁਸੀਂ ਜ਼ਰੂਰ ਪਲੀਜ਼ ਇਹਨਾਂ ਦਾ ਹੱਲ ਕਰਾਇਓ ਅਤੇ ਸਾਡੇ ਸਕੂਲਾਂ ਚ ਟੀਚਰਜ਼ ਵੀ ਨਹੀਂ ਅਵੇਲੇਬਲ ਹੈਗੇ ਜਿਸ ਕਰਕੇ ਬੱਚੇ ਦੀ ਪੜ੍ਹਾਈ ਵੀ ਖ਼ਰਾਬ ਹੋ ਰਹੀ ਆ ਨਾਲੇ ਸਕੂਲਾਂ ਦੀ ਬਿਲਡਿੰਗ ਵੀ ਬਹੁਤ ਪੁਰਾਣੀ ਹੋ ਗਈ ਉਹ ਦੀ ਮੈਨੂੰ ਇੱਕ ਡਰ ਬਣਿਆ ਰਹਿੰਦਾ ਹਾਂਜੀ ਅਤੇ ਕੀ ਕਹਿੰਦੇ ਆ ਖਾਲੇ ਵੀ ਨਹੀਂ ਸਾਫ਼ ਹੋਏ ਹੈਗੇ ਉਥੋਂ ਵੀ ਬਹੁਤ ਗੰਦਗੀ ਪੈ ਗਈ ਹੈ ਅਤੇ ਕੋਈ ਸਾਫ਼ ਨਹੀਂ ਕਰਦਾ ਖਾਲੇ ਹਾਂਜੀ ਬਹੁਤ ਗੰਦੇ ਹੋ ਗਏ ਆ ਅਤੇ ਕੋਈ ਸਫਾਈ ਨਹੀਂ ਕਰਾਉਂਦੇ ਜਿਹਦੇ ਕਰਕੇ ਉਥੇ ਬਹੁਤ ਗੰਦੇ ਮੱਛਰ ਪੈਦਾ ਹੋ ਗਏ ਆ ਤਾਂ ਕਰਕੇ ਸਾਡੇ ਪਿੰਡ 'ਚ ਡੇਂਗੂ ਦਾ ਖ਼ਤਰਾ ਬਹੁਤ ਜਿਆਦਾ ਵੱਧ ਗਿਆ ਬਾ ਕਾਫੀ ਜਣਿਆ ਨੂੰ ਡੇਂਗੂ ਹੋ ਚੁੱਕਿਆ ਪਲੀਜ ਤੁਸੀਂ ਸਰਵ ਕਰਨ ਜ਼ਰੂਰ ਆਇਓ ਸਾਡੇ ਪਿੰਡ 'ਚ ਅਤੇ ਸਾਡੇ ਸਾਡੇ ਦਿੱਕਤਾਂ ਨੂੰ ਨੋਟ ਕਰਕੇ ਜ਼ਰੂਰ ਲੈ ਕੇ ਜਾਇਓ ਅਤੇ ਨਾ ਉਹਨਾਂ ਦੇ ਹੱਲ ਜ਼ਰੂਰ ਕਰਿਓ ਜਲਦ ਤੋਂ ਜਲਦ ਹੱਲ ਕਰਿਓ ਕਿਉਂਕਿ ਨਾ ਹੁਣ ਧੁੰਦਾਂ ਕਰਕੇ ਬਹੁਤ ਦਿੱਕਤਾਂ ਆ ਰਹੀਆਂ ਨੇ ਲਾਈਟਾਂ ਕਰਕੇ ਤਾਂ ਜ਼ਰੂਰ ਬਈ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਅਤੇ ਜਲਦ ਤੋ ਜਲਦ ਹੱਲ ਕਰਵਾਇਓ ਠੀਕ ਹੈ ਜੀ ਧੰਨਵਾਦ ਜੀ